ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਨੇ ਕਿ ਇਹ ਇੱਕ ਤਾਂ ਹਿੰਦੀ ਨਾਲ ਥੋੜ੍ਹੀ ਜਿਹੀ ਮਿਲਦੀ ਜੁਲਦੀ ਹੈ ਜਿਸ ਕਰਕੇ ਇਹਨੂੰ ਸਮਝਣ ਵਿੱਚ ਪ੍ਰੋਬਲਮ ਨਹੀਂ ਹੁੰਦੀ ਦੂਜੀ ਗੱਲ ਇਹ ਹੈ ਕਿ ਇਹ ਬੜੀ ਪਿਆਰ ਦੀ ਮਿਲਾਪੜੀ ਭਾਸ਼ਾ ਹੈ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹਦੀ ਆਪਣੀ ਗਰਾਮਰ ਹੈ ਵਿਆਕਰਨ ਹੈ ਅਸੀਂ ਜਿਸ ਤਰੀਕੇ ਨਾਲ ਇਹਨੂੰ ਬੋਲਦੇ ਹਾਂ ਉਸ ਤਰੀਕੇ ਨਾਲ ਅਸੀਂ ਇਸਨੂੰ ਲਿਖ ਵੀ ਸਕਦੇ ਹਾਂ ਇਹਦੇ ਵਿੱਚ ਅੰਗਰੇਜ਼ੀ ਵਾਂਗ ਕੋਈ ਸ਼ਬਦ ਸਾਈਲੈਂਟ ਨਹੀਂ ਹੁੰਦਾ ਤੀਜੀ ਚੀਜ਼ ਇਹ ਹੈ ਕਿ ਪੰਜਾਬ ਦੀ ਇਸ ਭਾਸ਼ਾ ਵਿੱਚ ਨੂੰ ਟਰਾਂਸਲੇਟ ਕਰਨਾ ਬਹੁਤ ਸੌਖਾ ਹੈ ਸੰਸਕ੍ਰਿਤ ਵਿੱਚ ਉਰਦੂ ਵਿੱਚ ਜਾਂ ਹੋਰ ਭਾਸ਼ਾਵਾਂ ਵਿੱਚ ਅਤੇ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਇਹੋ ਜਿਹੇ ਹਨ ਜੋ ਕਿ ਬਹੁਤ ਸਰਲ ਹਨ